ਹੈਲੋ ਸਤਿ ਸ਼੍ਰੀ ਅਕਾਲ ਮੈਂ ਸੰਤੋਸ਼ ਕੁਮਾਰੀ ਗੁਰਦਾਸਪੁਰ ਤੋਂ ਬੋਲਦੀ ਪਈ ਹਾਂ ਮੈਂ ਤੁਹਾਨੂੰ ਯੋਗਾ ਦੇ ਫੈਸ਼ਨਾਂ ਬਾਰੇ ਜੋ ਹਾਡੇ ਦਿਮਾਗ 'ਚ ਸੋਚ ਵਿਚਾਰ ਆਉਂਦੀ ਹੈ ਮੈਂ ਉਸ ਬਾਰੇ ਤੁਹਾਨੂੰ ਗੱਲਬਾਤ ਕਰਨ ਲੱਗੀ ਹਾਂ ਤੁਹਾਡੇ ਨਾਲ ਤੁਹਾਡੇ ਜੀਵਨ ਵਿੱਚ ਮਤਲਬ ਕਿ ਕਿਵੇਂ ਹੋ ਸਕਦੀ ਸ਼ਾਮਿਲ ਯੋਗ ਸਾਡੇ ਦਿਮਾਗ ਨੂੰ ਸੋਚ ਨੂੰ ਸ਼ਾਂਤ ਰੱਖਦਾ ਜਦੋਂ ਅਸੀਂ ਸਵੇਰੇ ਉੱਠ ਕੇ ਯੋਗਾ ਕਰਦੇ ਹਾਂ ਤਾਂ ਉਸ ਨਾਲ ਸਾਡਾ ਦਿਮਾਗ ਜਿਹੜਾ ਸ ਬਿਲਕੁਲ ਫਰੈਸ਼ ਹੋ ਜਾਂਦਾ ਵਾ ਜਿਹੜੀ ਵੀ ਦਿਮਾਗ ਦੀ ਥਕਾਵਟ ਹੁੰਦੀ ਹੈ ਉਹ ਦੂਰ ਹੋ ਜਾਂਦੀ ਹੈ ਅਤੇ ਅਸੀਂ ਜਿਹੜਾ ਆਪਣਾ ਦਿਮਾਗ ਆ ਬਿਲਕੁਲ ਫਰੈਸ਼ ਰੱਖ ਸਕਦੇ ਹਾਂ ਅਤੇ ਇਸਨੂੰ ਅਸੀਂ ਆਪਣੇ ਜੀਵਨ ਵਿੱਚ ਇਸ ਤਰ੍ਹਾਂ ਸ਼ਾਮਿਲ ਕਰਨਾ ਹੈ ਕਿ ਜਿਵੇਂ ਆਪਾਂ ਰੋਟੀ ਖਾਣੀ ਨਹੀਂ ਭੁਲਦੇ ਹੈਗੇ ਕਿ ਆਹ ਖਾਣੀ ਖਾਣੀ ਆ ਇਸ ਲਈ ਯੋਗ ਵੀ ਸਾਡੇ ਦਿਮਾਗ ਲਈ ਬਹੁਤ ਜ਼ਰੂਰੀ ਹੈ ਕਿ ਇਹ ਅਸੀਂ ਕਰਨਾ ਹੀ ਕਰਨਾ ਵਾ ਠੀਕ ਆ ਭਾਵੇਂ ਜੋ ਮਰਜ਼ੀ ਹੋਏ ਸਾਨੂੰ ਯੋਗ ਕਰਨਾ ਹੀ ਕਰਨਾ ਯੋਗ ਦੇ ਨਾਲ ਸਾਡੇ ਦਿਮਾਗ ਨੂੰ ਬਹੁਤ ਵਧੀਆ ਫਾਇਦੇ ਹੁੰਦੇ ਹਨ ਦਿਮਾਗ ਨੂੰ ਰੈਸਟ ਮਿਲਦੀ ਆ ਫਿਰ ਦਿਮਾਗ ਸ਼ਾਂਤ ਰਹਿੰਦਾ ਹੈ ਅਤੇ ਦਿਮਾਗ 'ਤੇ ਕੋਈ ਜ਼ਿਆਦਾ ਪਰੇਸ਼ਾਨੀ ਨਹੀਂ ਪੈਂਦੀ ਦਿਮਾਗ 'ਤੇ ਟੈਨਸ਼ਨ ਨਹੀਂ ਪੈਂਦੀ ਇਸ ਲਈ ਸਾਨੂੰ ਯੋਗ ਬਾਰੇ ਆਪਣੇ ਦਿਮਾਗੀ ਸੋਚ ਨੂੰ ਇਸ ਤਰ੍ਹਾਂ ਪੈਦਾ ਕਰਨਾ ਹੈ ਕਿ ਤਾਂ ਕਿ ਆਪਾਂ ਬਿਲਕੁਲ ਵਧੀਆ ਤਰੀਕੇ ਨਾਲ ਯੋਗ ਪੈਦਾ ਕਰ ਸਕੀਏ ਆਪਣਾ ਯੋਗਾ ਕਰੀਏ ਤਾਂ ਕਿ ਸਾਡਾ ਦਿਮਾਗ ਤੰਦਰੁਸਤ ਰਹਿ ਸਕੇ ਇਸ ਨਾਲ ਸਾਡਾ ਲਾਈਫਟਾਈਮ ਕਾਫੀ ਵਧੀਆ ਰਹਿੰਦਾ ਹੈ ਜੇ ਆਹ ਸਾਡਾ ਦਿਮਾਗ ਠੀਕ ਰਹੇਗਾ ਤਾਂ ਹੀ ਆਪਾਂ ਸਾਰਾ ਦਿਨ ਕੋਈ ਵੀ ਕੰਮ ਕਰ ਸਕਦੇ ਹਾਂ ਜੇ ਸਾਡਾ ਦਿਮਾਗ ਦੀ ਸੰਤੁਲਨ ਸ਼ਹੀ ਸਹੀ ਨਹੀਂ ਰਹੇਗਾ ਅਤੇ ਅਸੀਂ ਆਪਣੇ ਦਿਮਾਗ ਨੂੰ ਸਹੀ ਤਰੀਕੇ ਨਾਲ ਨਹੀਂ ਵਰਤ ਸਕਦੇ ਅਤੇ ਆਪਾਂ ਕੋਈ ਵੀ ਕੰਮ ਪੂਰੀ ਤਰ੍ਹਾਂ ਨਹੀਂ ਕਰ ਸਕਦੇ ਇਸ ਲਈ ਸਾਨੂੰ ਆਪਣੇ ਦਿਮਾਗ ਬਾਰੇ ਵਧੀਆ ਰਹਿਣਾ ਚਾਹੀਦਾ ਹੈ ਦਿਮਾਗ ਬਾਰੇ ਸੋਚ ਕੇ ਸਾਨੂੰ ਯੋਗਾ ਕਰਨਾ ਚਾਹੀਦਾ ਹੈ ਇਸ ਲਈ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ